ਮੈਂ ਗੁਰਦਾਸਪੁਰੋਂ ਹਰਜੀਤ ਕੌਰ ਬੋਲਦੀ ਪਈ ਆਂ ਸਾਸਰੀ ਕਾਲ ਜੀ ਅਸੀਂ ਕੱਪੜੇ ਜਿਹੜੇ ਐ ਡਿਫਰੈਂਟ ਜਿਹੜੇ ਕੱਪੜੇ ਅਸੀਂ ਆਪਣੇ ਜਿਹੜੇ ਕੱਪੜੇ ਹੈਗੇ ਆ ਉਹ ਅਸੀਂ ਆਪਣੇ ਕੱਪੜੇ ਘਰ ਸੀਨੇਂ ਆਂ ਕਿਉਂਕੀ ਇੱਕ ਤਾਂ ਜਿਹੜਾ ਘਰ ਦਾ ਕੱਪੜਾ ਹੁੰਦਾ ਵਾ ਉਹਨੂੰ ਸੀਣ ਵਾਸਤੇ ਅਸੀਂ ਆਪਣਾ ਜਿਹੜਾ ਕੱਪੜਾ ਘਰ ਬੈਠ ਕੇ ਸੀਨੇਂ ਆਂ ਤੇ ਅਹੀਂ ਆਪਣੇ ਘਰ ਸਿਲਾਈ ਵੀ ਕਰ ਲੈਨੇ ਆਂ ਤੇ ਉਹਦੇ ਵਿੱਚ ਜਿਹੜੇ ਮਤਲਬ ਕੀ ਰੈਡੀਮੇਡ ਕੱਪੜੇ ਹੁੰਦੇ ਆ ਉਹ ਕੱਚੀਆਂ ਸੀਣਾ ਹੁੰਦੀਆਂ ਵਾਂ ਤੇ ਜਦੋਂ ਉਨ੍ਹਾਂ ਨੂੰ ਰੈਡੀਮੇਡ ਕੱਪੜਿਆਂ ਨੂੰ ਘਰ ਵੀ ਲੈ ਆਓ ਤੇ ਤਾਂ ਵੀ ਉਨ੍ਹਾਂ ਨੂੰ ਪੱਕੇ ਕਰਨਾ ਪੈਂਦਾ ਵਾ ਜਿਹੜੇ ਅਸੀਂ ਆਪਣੇ ਕੱਪੜੇ ਕਰਦੇ ਆਂ ਸੀਨੇਂ ਆਂ ਉਹੀ ਚੰਗੀ ਤਰ੍ਹਾਂ ਉਨ੍ਹਾਂ ਨੂੰ ਨਾਪ ਨਾਪ ਕੇ ਇੰਚੀਟੇਪ ਲੈ ਕੇ ਉਨ੍ਹਾਂ ਦਾ ਸਾਰਾ ਈ ਇਹ ਕਰਕੇ ਲੰਬਾਈ ਚੜ੍ਹਾਈ ਵੇਖ ਕੇ ਫੇਰ ਉਹਨੂੰ ਬਣਾਈ ਦਾ ਵਾ ਤੇ ਉਹਦੇ ਵਿੱਚ ਮਤਲਬ ਕਿ ਇੱਕ ਤਾਂ ਸੀਣਾ ਬੜੀਆਂ ਪੱਕੀਆਂ ਵੱਜ ਜਾਂਦੀਆਂ ਵਾਂ ਤੇ ਇੱਕ ਆਪਣੀ ਮਰਜੀ ਦਾ ਸੀਂ ਲਈ ਦਾ ਸੀਂ ਲਈ ਦਾ ਇੱਕ ਤੇ ਬਾਹਰ ਜਦੋਂ ਕੱਪੜਾ ਸਵਾਉਣ ਜਾਓ ਉਹਦੀ ਸੁਵਾਈ ਬੜੀ ਆ ਇਸ ਕਰਕੇ ਸਾਡੀ ਜਿਹੜੀ ਸੁਵਾਈ ਐ ਉਹ ਵੀ ਬੱਚ ਜਾਂਦੀ ਹੈ ਜਿਹੜੇ ਰੈਡੀਮੇਡ ਕੱਪੜੇ ਹੈਗੇ ਆ ਉਨ੍ਹਾਂ ਨੂੰ ਘਰ ਲੈ ਵੀ ਆਓ ਉਨ੍ਹਾਂ ਦੀ ਨਾ ਕੋਈ ਲੰਬਾਈ ਪੂਰੀ ਹੁੰਦੀ ਐ ਨਾ ਕੋਈ ਉਨ੍ਹਾਂ ਦੀ ਚੌੜਾਈ ਪੂਰੀ ਹੁੰਦੀ ਐ ਨਾ ਉਹਦੇ ਵਿੱਚ ਕੋਈ ਕੱਪੜਾ ਹੁੰਦਾ ਵਾ ਕੀ ਉਹ ਜਿਹੜਾ ਮਤਲਬ ਕੀ ਅਸੀਂ ਲਾ ਕੇ ਉਹਨੂੰ ਠੀਕ ਕਰ ਲੀਏ ਇੱਕ ਤਾਂ ਉਹਦੀਆਂ ਕੱਚੀਆਂ ਸੀਣਾ ਐਨੀਆਂ ਕ ਹੁੰਦੀਆਂ ਵਾਂ ਕੀ ਉਹਨੂੰ ਘਰ ਆ ਕੇ ਸੀਣਾ ਜਿਹੜੀਆਂ ਵਾ ਉਹ ਮਾਰਨੀਆਂ ਹੀ ਪੈਂਦੀਆਂ ਵਾਂ ਤੇ ਜਿਹੜੇ ਹੁੰਦੇ ਆ ਕੀ ਜਿਹੜੇ ਲੋਕ ਜਿਹੜੇ ਕਈ ਲੋਕ ਵਾ ਉਹ ਕੱਪੜੇ ਘਰ ਚੋਂ ਹੀ ਪੀ ਜਿਵੇਂ ਇਹ ਦਰਜੀ ਕੋਂ ਹੀ ਕੱਪੜਾ ਲੈ ਕੇ ਸੁਆਉਣਾ ਮਤਲਬ ਕੀ ਪਸੰਦ ਕਰਦੀਆਂ ਵਾਂ ਤੇ ਜਿਹੜੀਆਂ ਅੱਜ ਕੱਲ ਦੀਆਂ ਕੁੜੀਆਂ ਹੈਗੀਆਂ ਉਹ ਰੈਡੀਮੇਡ ਪਸੰਦ ਕਰਦੀਆਂ ਵਾਂ ਇਸ ਕਰਕੇ ਉਨ੍ਹਾਂ ਨੂੰ ਵੀ ਘਰ ਆ ਕੇ ਕੱਪੜੇ ਜਿਹੜੇ ਹੈਗੇ ਆ ਉਨ੍ਹਾਂ ਨੂੰ ਵੀ ਠੀਕ ਵਗੈਰਾ ਕਰਨੇ ਹੀ ਪੈਂਦੇ ਆ ਅੱਗੇ ਤਰਪਾਈ ਆ ਅਹੀਂ ਜਦੋਂ ਆਪਣੇ ਘਰ ਕੱਪੜਾ ਸੀਨੇਂ ਆਂ ਉਹਦੀ ਤਰਪਾਈ ਐਨੀ ਕ ਵਧੀਆ ਕਰੀਦੀ ਆ ਕੀ ਉਹਨੂੰ ਮਤਲਬ ਕੀ ਉਧੜਨ ਦਾ ਤਾਂ ਉਹਦਾ ਕੋਈ ਮਤਲਬ ਈ ਨੀ ਰਹਿ ਜਾਂਦਾ ਜਿਹੜੇ ਅਸੀਂ ਬਜਾਰੋਂ ਕੱਪੜੇ ਲੈਨੇ ਆਂ ਉਹਦੀ ਜਿਹੜੀ ਨਾ ਉਹਦੀ ਤਰਪਾਈ ਸਈ ਹੋਈ ਹੁੰਦੀ ਆ ਨਾ ਉਹਦੀਆਂ ਸੀਣਾਂ ਚੰਗੀ ਤਰ੍ਹਾਂ ਵੱਜੀਆਂ ਹੁੰਦੀਆਂ ਵਾਂ ਹੈਂਅ ਉਹ ਸਾਰੀਆਂ ਹੀ ਐਨੀਆਂ ਮਤਲਬ ਕੀ ਬੇਕਾਰ ਜਿਆ ਕੱਪੜਾ ਲੱਗਦਾ ਇਸ ਕਰਕੇ ਅਸੀਂ ਆਪਣੇ ਜਿਹੜੇ ਕੱਪੜੇ ਹੈਗੇ ਉਹ ਅਹੀਂ ਆਪਣੇ ਘਰ ਦੇ ਹੀ ਸੀਂ ਕੇ ਪਸੰਦ ਕਰਨੇ ਆਂ ਦੋ ਦੋ ਸੀਣਾਂ ਮਾਰ ਕੇ ਫਸਕਲਾਸ ਕੱਪੜਾ ਬਣਾ ਕੇ ਤੇ ਉਹਨੂੰ ਮਤਲਬ ਕੇ ਅਹੀਂ ਪਾਉਨੇ ਆਂ